ਸਾਡੇ ਇਲਾਕੇ ਵਿੱਚ ਗਿਣੇ ਚੁਣੇ ਇੱਕ ਦੋ ਹੀ ਡੌਕਟਰ ਹਨ ਅਤੇ ਪੂਰੇ ਇਲਾਕੇ ਦੇ ਲੋਕਾਂ ਨੂੰ ਉਹੀ ਵੇਖਦੇ ਹਨ ਅਤੇ ਸਿਹਤ ਸੰਭਾਲ ਕਰਮਚਾਰੀਆਂ ਨੂੰ ਸਿਖਲਾਈ ਦੇਣ ਲਈ ਜਿਹੜੇ ਵਿਦਿਅਕ ਅਦਾਰੇ ਹਨ ਉਹ ਵੀ ਬਹੁਤ ਘੱਟ ਹਨ ਮੀਨਜ ਬੇਨਾਮੇਂ ਹੀ ਹਨ ਅਤੇ ਉਹ ਵੀ ਮੀਨਜ਼ ਪੂ ਪੂਰੀ ਤਰ੍ਹਾਂ ਪ੍ਰਫੈਕਟ ਸੰਪੂਰਨ ਨਹੀਂ ਹਨ ਡੌਕਟਰ ਨਰਸਾਂ ਅਤੇ ਸਰਜਨ ਆਦਿ ਨੂੰ ਚੰਗੀ ਤਰ੍ਹਾਂ ਸਿਖਲਾਈ ਦੇਣ ਵਾਸਤੇ ਅਸੀਂ ਕੋਈ ਕਹੇ ਵੀ ਇਸ ਸੰਸਥਾ ਦਾ ਪ੍ਰਬੰਧ ਨਹੀਂ ਹੈ ਅਤੇ ਜਿਹੜੇ ਮੈਡੀਕਲ ਜਾਂ ਨਰਸਿੰਗ ਜਿਹੜੇ ਵਿਦਿਆਰਥੀ ਆ ਉਹਨਾਂ ਨੂੰ ਪੜ੍ਹਨ ਵਾਸਤੇ ਦੂਰ ਸ਼ਹਿਰਾਂ ਵਿੱਚ ਜਾਣਾ ਪੈਂਦਾ ਹੈ ਸਾਡੇ ਨਿੱਜੀ ਇਲਾਕੇ ਦੇ ਵਿੱਚ ਇਹਨਾਂ ਵਾਸਤੇ ਇਹਨਾਂ ਦੀ ਟ੍ਰੇਨਿੰਗ ਵਗੈਰਾ ਵਾਸਤੇ ਸਿਖਲਾਈ ਵਾਸਤੇ ਕੋਈ ਵੀ ਖ਼ਾਸ ਪ੍ਰਬੰਧ ਨਹੀਂ ਹੈ ਅਗਰ ਬੱਚੇ ਮੈਡੀਕਲ ਜਾਂ ਨਰਸਿੰਗ ਕੁਛ ਕਰਨਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਆਪਣੇ ਸਥਾਨ ਨੂੰ ਛੱਡ ਕੇ ਦੂਰ ਸ਼ਹਿਰਾਂ ਵਿੱਚ ਜਾ ਕੇ ਇਹ ਸਿਖਲਾਈ ਪ੍ਰਾਪਤ ਕਰਨੀ ਪੈਂਦੀ ਹੈ ਅਤੇ ਸਾਡੇ ਇਲਾਕੇ ਦੇ ਵਿੱਚ ਵਿੱਦਿਅਕ ਅਦਾਰਿਆਂ ਦੀ ਵੀ ਘਾਟ ਹੈ ਅਤੇ ਡੌਕਟਰਾਂ ਦੀ ਵੀ ਘਾਟ ਹੈ ਅਤੇ ਔਰ ਜੋ ਡੌਕਟਰ ਅਤੇ ਨਰਸਾਂ ਅਤੇ ਸਰਜਨ ਬਣਨਾ ਚਾਹੁੰਦੇ ਹਨ ਉਹਨਾਂ ਨੂੰ ਆਪਣੀ ਮੈਡੀਕਲ ਦੀ ਪੜ੍ਹਾਈ ਕਰਨ ਵਾਸਤੇ ਦੂਰ ਸ਼ਹਿਰਾਂ ਵਿੱਚ ਜਾਣਾ ਪੈਂਦਾ ਹੈ